ਆਨਲਾਈਨ ਸਕੂਲਿੰਗ ਅਤੇ ਕੋਚਿੰਗ ਨੇ ਬੱਚਿਆਂ ਦੇ ਜੀਵਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਜਿਹੜੇ ਅੱਜ ਕੱਲ੍ਹ ਦੇ ਬੱਚੇ ਹਨ ਪਹਿਲੀ ਗੱਲ ਤਾਂ ਫੋਨ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ ਠੀਕ ਹੈ ਇਸ ਕਰਕੇ ਉਹਨਾਂ ਨੂੰ ਹੁਣ ਪੜ੍ਹਾਈ ਵੀ ਜਿਹੜੀ ਆ ਫੋਨ ਦੇ ਨਾਲ ਹੀ ਵਧੀਆ ਲੱਗਦੀ ਹੈ ਜਿਹੜੀ ਦੂਸਰੀ ਪੜ੍ਹਾਈ ਨੋਰਮਲੀ ਟੀਚਰਸ ਪੜ੍ਹਾਉਂਦੇ ਹੁੰਦੇ ਸੀਗੇ ਹੁਣ ਉਹਨਾਂ ਨੂੰ ਉਹ ਚੀਜ਼ਾਂ ਵਧੀਆ ਨਹੀਂ ਲੱਗਦੀਆਂ ਹੁਣ ਜਿਹੜੀ ਸਮਾਰਟ ਕਲਾਸਸ ਆ ਗਈਆਂ ਆਨਲਾਈਨ ਆ ਗਈਆਂ ਇਹਨਾਂ ਨੇ ਕਿ ਹੋ ਗਿਆ ਇੱਕ ਤਾਂ ਬੱਚਿਆਂ ਨੂੰ ਵਧੀਆ ਲੱਗਦਾ ਹੈ ਇੱਕ ਤਾਂ ਇਜ਼ੀਲੀ ਸਮਝ ਪਾਉਂਦੇ ਆ ਚੀਜ਼ ਠੀਕ ਆ ਦੂਸਰਾ ਉਹ ਮਿਊਜਿਕ ਜੋ ਵੀ ਉਹ ਚਲਾਉਂਦੇ ਹਨ ਠੀਕ ਹੈ ਮਿਊਜਿਕ ਕਲਾਜਿਜ ਵਗੈਰਾ ਉਹਨਾਂ ਨੂੰ ਵੀ ਇੰਜੋਏ ਕਰ ਪਾਉਂਦੇ ਹਨ ਹਰ ਚੀਜ਼ ਨੂੰ ਆਨਲਾਈਨ ਨਾਲ ਕੀ ਕਰ ਸਕਦੇ ਹਨ ਮਤਲਬ ਕਿ ਉਨ੍ਹਾਂ ਨੂੰ ਪਤਾ ਲੱਗਦਾ ਕਿ ਅਸੀਂ ਹੀ ਸਿੱਖਣਾ ਹੈ ਕਿਸ ਚੀਜ਼ ਬਾਰੇ ਅਸੀਂ ਜਾਨਣਾ ਹੈ ਆਫਲਾਈਨ ਦੇ ਵਿੱਚ ਜਿਹੜੇ ਹੁਣ ਬੱਚੇ ਸੀਗੇ ਉਹ ਪਹਿਲਾਂ ਬਹੁਤ ਜਿਆਦਾ ਡਰਦੇ ਹੁੰਦੇ ਸੀਗੇ ਬਟ ਹੁਣ ਕੀ ਆ ਆਨਲਾਈਨ ਵਿੱਚ ਉਹਨਾਂ ਨੂੰ ਕੋਈ ਵੀ ਇਹੋ ਜਿਹਾ ਡਰ ਨਹੀਂ ਹੈਗਾ ਉਹ ਕੁਝ ਵੀ ਇਸ ਲਈ ਪੁੱਛ ਲੈਂਦੇ ਹਨ ਅਤੇ ਆਨਲਾਈਨ ਸਕੂਲਿੰਗ ਦੇ ਨਾਲ ਇਹ ਫਰਕ ਪਿਆ ਕਿ ਜਿਹੜੇ ਹੁਣ ਇਜੀਲੀ ਕੰਮ ਕਰਨਾ ਹੋ ਗਿਆ ਠੀਕ ਹੈ ਨਾਲ ਨਾਲ ਟੀਚਰ ਪੜ੍ਹਾਉਂਦੇ ਆ ਅਤੇ ਨਾਲ ਨਾਲ ਬੱਚੇ ਕੰਮ ਕਰਦੇ ਹਨ ਠੀਕ ਹਨ ਅਤੇ ਉਹਨਾਂ ਨਾਲ ਹੋਮਵਰਕ ਕਰਨਾ ਵੀ ਆਸਾਨ ਹੋ ਗਿਆ ਠੀਕ ਹੈ ਇਸ ਕਰਕੇ ਆਨਲਾਈਨ ਸਕੂਲਿੰਗ ਅਤੇ ਕੋਚਿੰਗ ਜਿਹੜੀ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ ਬੱਚਿਆਂ ਨੂੰ ਮੋਟੀਵੇਟ ਕਰ ਰਹੀ ਪੜ੍ਹਨ ਲਈ ਲੇਕਿਨ ਬੱਚੇ ਜਿਹੜੇ ਜ਼ਿਆਦਾ ਪੜ੍ਹਨ ਵੱਲ ਘੱਟ ਅਤੇ ਗੇਮਾਂ ਗੁੰਮਾਂ ਵੱਲ ਜਿਆਦਾ ਧਿਆਨ ਦਿੰਦੇ ਹਨ ਪਰ ਫਿਰ ਵੀ ਥੋੜ੍ਹਾ ਜਿਹਾ ਫੋਨ ਦੀ ਵਰਤੋਂ ਦੇ ਲਈ ਆਨਲਾਈਨ ਸਕੂਲਿੰਗ ਨੂੰ ਅਟਰੈਕਟ ਹੋ ਰਹੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਫੋਨ ਤਾਂ ਹੀ ਮਿਲੇਗਾ ਜੇ ਉਹ ਪੜ੍ਹਨਗੇ ਇਸ ਲਈ ਆਨਲਾਈਨ ਸਕੂਲਿੰਗ ਅਤੇ ਕੋਚਿੰਗ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ